ਡੇਂਗੂ ਮੱਛਰ ਸਾਫ ਪਾਣੀ ਜਿਵੇਂ ਘਰਾਂ ਵਿੱਚ ਫਰਿੱਜਾਂ ਦੇ ਵੇਸਟ ਟੁੱਟੇ ਭੱਜੇ ਬਰਤਨ ਬਰਸਾਤ ਦੇ ਪਏ ਪਾਣੀ ਪਸ਼ੂਆਂ ਪੰਛੀਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ ਬਰਸਾਤਾਂ ਦੇ ਖੜ੍ਹੇ ਪਾਣੀ ਨਾਲ ਹੁੰਦਾ ਹੈ ਆਪਣੇ ਘਰਾਂ ਦੇ ਆਸ ਪਾਸ ਪਾਣੀ ਨਹੀਂ ਖੜ੍ਹਨ ਦਿੰਦਾ ਜਾ ਕੇ ਡੇਂਗੂ ਬੁਖਾਰ ਦੇ ਮਰੀਜ਼ ਦਾ ਇਲਾਜ ਸਾਰੇ ਸਰਕਾਰੀ ਸਿਹਤ ਸੈਂਟਰ ਵਿੱਚ ਮੁਫਤ ਹੁੰਦਾ ਹੈ ਇਸ ਦੇ ਨਾਲ ਹੀ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਾਲਾ ਪੀਲੀਆ ਵਰਤੀਆ ਸੂਈਆਂ ਮਰੀਜ਼ਾਂ ਦੇ ਦੁਬਾਰਾ ਵਰਤਣ ਮਰੀਜ਼ ਨੂੰ ਦੂਸ਼ਿਤ ਖੂਨ ਦੇਣ ਨਾਲ ਅਤੇ ਹੈਜ਼ੈ ਬਾਰੇ ਇਹ ਮੱਖੀਆਂ ਦੇ ਦੂਸ਼ਿਤ ਖਾਣਾ ਖਾਣ ਨਾਲ ਹੁੰਦੀ ਹੈ ਇਸ ਦੇ ਬਚਾਓ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਇਸ ਤੋਂ ਬਾਅਦ ਹਲਕਾਅ ਬਾਰੇ ਜਾਣਕਾਰੀ ਦਿੱਤੀ ਗਈ ਹਲਕਾਅ ਅਵਾਰਾ ਕੁੱਤੇ ਜਾਂ ਘਰਾਂ ਵਿੱਚ ਰੱਖੇ ਪਾਲਤੂ ਕੁੱਤੇ ਬਾਂਦਰ ਨੇਵਲੇ ਅਤੇ ਕਿਸੇ ਮਨੁੱਖ ਨੂੰ ਕੱਟਣ ਨਾਲ ਹੁੰਦਾ ਹੈ ਇਸ ਤੋਂ ਬਚਾਓ ਲਈ ਮਨੁੱਖ ਦੇ ਤੁਰੰਤ ਨਜ਼ਦੀਕੀ ਸਿਹਤ ਸੈਂਟਰ ਤੋਂ ਟੀਕਾ ਲਗਾਇਆ ਜਾਣਾ ਟੀਕੇ ਸਾਰੇ ਸਰਕਾਰੀ ਸਿਹਤ ਸੈਂਟਰ ਵਿੱਚ ਮੁਫਤ ਲਗਾਏ ਜਾਂਦੇ ਹਨ ਅਤੇ ਅਸੀਂ ਇਸ ਤੋਂ ਬਚਣ ਲਈ ਕੁਛ ਨਾ ਕੁਛ ਆਪਣੇ ਘਰਾਂ ਵਿੱਚ ਬਾਹਰ ਸਪਰੇ ਕਰਾ ਸਕਦੇ ਹਨ ਤਾਂ ਕਿ ਡੇਂਗੂ ਅਤੇ ਮਲੇਰੀਆ ਦੇ ਮੱਛਰ ਪੈਦਾ ਨਾ ਹੋਣ ਅਤੇ ਲੋਕਾਂ ਨੂੰ ਇਹ ਨਾ ਕੱਟ ਸਕਣ ਕਿਉਂਕਿ ਮੱਛਰ ਕੱਟਣ ਨਾਲ ਇਹ ਬਿਮਾਰੀ ਅੱਗੇ ਤੋਂ ਅੱਗੇ ਫੈਲਦੀ ਹੈ ਡੇਂਗੂ ਬੁਖਾਰ ਬੱਚਿਆਂ ਵਿੱਚ ਜ਼ਿਆਦਾ ਹੁੰਦਾ ਹੈ ਖਾਸ ਕਰਕੇ ਪੰਦਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ